ਪੰਜਾਬ ਰਾਜ ਲੋਕ ਗੀਤਾਂ ਨਾਲ ਬਹੁਤ ਹੀ ਪ੍ਰਚਲਿਤ ਹੈ ਇਥੇ ਵੱਖ ਵੱਖ ਦਿਨ ਤਿਉਹਾਰਾਂ ਤੇ ਵੱਖ ਵੱਖ ਲੋਕ ਗੀਤ ਗਾਏ ਜਾਂਦੇ ਹਨ ਜਦੋਂ ਵੀ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਮੁੰਡੇ ਵਾਲੀ ਸਾਈਡ ਤੋਂ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੀ ਸਾਈਡ ਤੋਂ ਸੁਹਾਗ ਵਾਲੇ ਗੀਤ ਗਾਏ ਜਾਂਦੇ ਹਨ ਤੇ ਜਦੋਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤਾਂ ਲੋੜੀ ਵਾਲੇ ਗੀਤ ਗਾ ਕੇ ਲੋੜੀ ਨੂੰ ਮਨਾਇਆ ਜਾਂਦਾ ਹੈ ਸਾਵਣ ਦਾ ਮਹੀਨਾ ਜੋ ਕਿ ਵਿਆਹੀਆਂ ਹੋਈਆਂ ਕੁੜੀਆਂ ਲਈ ਇਕ ਵਧੀਆ ਤਿਹਾਰ ਬਣਾਇਆ ਗਿਆ ਹੈ ਜਿਸ ਵਿੱਚ ਜਦੋਂ ਵੀ ਕੁੜੀਆਂ ਆਪਣੇ ਪੇਕੇ ਵਾਪਸ ਆਉਂਦੀਆਂ ਹਨ ਤਾਂ ਸੋਹਣ ਦਾ ਮਹੀਨਾ ਮਨਾਇਆ ਜਾਂਦਾ ਹੈ ਇਸ ਵਿੱਚ ਉਹ ਕਿੱਕਲੀਆਂ ਪਾਉਂਦੀਆਂ ਹਨ ਤੇ ਬੋਲੀਆਂ ਪਾ ਕੇ ਗਿੱਦਾ ਪਾਉਂਦੀਆਂ ਹਨ ਉਸ ਤੋਂ ਇਲਾਵਾ ਜਦੋਂ ਵੀ ਕਿਸੇ ਘਰ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਜਨਮ ਦੇ ਗੀਤ ਗਾਏ ਜਾਂਦੇ ਹਨ ਇਸ ਤੋਂ ਇਲਾਵਾ ਸਿਠਣੀਆਂ ਇਹ ਵੀ ਵਿਆਹ ਦੇ ਵਿੱਚ ਗਾਈਆਂ ਜਾਂਦੀਆਂ ਹਨ ਛੰਦ ਪਰਾਗਾ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਟੱਪੇ ਅਤੇ ਬੋਲੀਆਂ ਪਾ ਕੇ ਕੁੜੀਆਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀਆਂ ਹਨ ਬੱਚਿਆਂ ਨੂੰ ਲੋਰੀਆਂ ਗਾ ਕੇ ਉਹਨਾਂ ਨੂੰ ਸਵਾਇਆ ਜਾਂਦਾ ਹੈ ਹੁੱਲੇ ਹੁਲਾਰੇ ਦੇ ਗੀਤ ਗਾ ਕੇ ਆਪਣੇ ਮਨ ਦਾ ਮਨੋਰੰਜਨ ਕੀਤਾ ਜਾਂਦਾ ਹੈ